ਹੈਲੋ ਸਤਿ ਸ਼੍ਰੀ ਅਕਾਲ ਮੈਂ ਪ੍ਰਿਯਾ ਧੀਰ ਬੋਲ ਰਹੀ ਹਾਂ ਸਰ ਭਗਤ ਜੀ ਤੋਂ ਬੋਲ ਰਹੇ ਹਾਂ ਸਰ ਮੈਂ ਥੋੜ੍ਹਾ ਟਾਈਮ ਪਹਿਲਾਂ ਹੀ ਇੱਕ ਔਡਰ ਕੀਤਾ ਸੀ ਜਿਹਦੇ ਵਿੱਚ ਮੈਂ ਦੋ ਪਲੇਟ ਮਿਕਸ ਵੈੱਜ ਰਾਇਤਾ ਦੋ ਪਲੇਟ ਦਾਲ ਮੱਖਨੀ ਦੋ ਪਲੇਟ ਮਨਚੂਰੀਅਨਸ ਅਤੇ ਦਸ ਨਾਨ ਕੀਤੇ ਸੀਗੇ ਉਹ ਔਡਰ ਮੈਨੂੰ ਥੋੜ੍ਹਾ ਟਾਈਮ ਪਹਿਲਾਂ ਹੀ ਹੁਣ ਡਿਲੀਵਰ ਹੋਇਆ ਏ ਆ ਬਟ ਜਦੋਂ ਮੈਂ ਉਹਨੂੰ ਔਡਰ ਨੂੰ ਖੋਲ੍ਹ ਕੇ ਦੇਖਿਆ ਨਾ ਤਾਂ ਉਹਦੇ ਵਿੱਚ ਤੁਸੀਂ ਜੋ ਵੀ ਗਿਣਤੀ ਭੇਜੀ ਸੀਗੀ ਉਹਦੀ ਮਾਤਰਾ ਬਹੁਤ ਹੀ ਜ਼ਿਆਦਾ ਘੱਟ ਸੀਗੀ ਅਤੇ ਇਹ ਉਹ ਵਾਲਾ ਔਡਰ ਨਹੀਂ ਸੀਗਾ ਜੋ ਮੈਂ ਕੀਤਾ ਸੀ ਇਹਦੇ ਵਿੱਚ ਮੈਨੂੰ ਪਿੱਜ਼ਾ ਮਿਲਿਆ ਬਰਗਰ ਵ ਮਿਲਿਆ ਅਤੇ ਇਹ ਚੀਜ਼ਾਂ ਮੈਂ ਔਡਰ ਨਹੀਂ ਕੀਤੀਆਂ ਸੀਗੀਆਂ ਤੁਸੀਂ ਕਿਰਪਾ ਕਰਕੇ ਮੈਨੂੰ ਦੱਸ ਦਉ ਕਿ ਤੁਸੀਂ ਇਹ ਔਡਰ ਨੂੰ ਕਿੰਨੀ ਜਲਦੀ ਇੱਥੋਂ ਮੇਰੇ ਕੋਲੋਂ ਵਾਪਸ ਲਿਜਾ ਕੇ ਮੈਨੂੰ ਮ ਜੋ ਔਡਰ ਮੈਂ ਕੀਤਾ ਸੀ ਉਹ ਡਿਲੀਵਰ ਕਰ ਸਕਦੇ ਹਾਂ ਜਾਂ ਫਿਰ ਤੁਸੀਂ ਇਹਦੇ ਲਈ ਜੋ ਵੀ ਪ੍ਰੋਸੀਜਰ ਫੋਲੋ ਕਰਨਾ ਚਾਹੁੰਦੇ ਹੋ ਮੈਨੂੰ ਜਲਦੀ ਤੋਂ ਜਲਦੀ ਦੱਸ ਦਓ ਕਿਉਂਕਿ ਮੈਂ ਆਪਣਾ ਇੱਕ ਫੈਮਲੀ ਫੰਕਸ਼ਨ ਦੇ ਲਈ ਇਹ ਚੀਜ਼ਾਂ ਔਡਰ ਕੀਤੀਆਂ ਸੀਗੀਆਂ ਬਟ ਜੇ ਤੁਸੀਂ ਮੈਨੂੰ ਟਾਈਮ 'ਤੇ ਹੁਣ ਇਹ ਚੀਜ਼ਾਂ ਨਾ ਪਹੁੰਚਾਈਆਂ ਤਾਂ ਇਹ ਮੇਰੇ ਲਈ ਬਹੁਤ ਗਲਤ ਹੋ ਜਾਏਗਾ ਤਾਂ ਮੈਂ ਤੁਹਾਨੂੰ ਰਿਕੁਐਸਟ ਕਰ ਰਹੀ ਹਾਂ ਕਿ ਮ ਇਹ ਵਾਲਾ ਔਡਰ ਚੇਂਜ ਕਰਕੇ ਜੋ ਔਡਰ ਮੈਂ ਕੀਤਾ ਸੀ ਉਹ ਮੈਨੂੰ ਜਲਦੀ ਤੋਂ ਜਲਦੀ ਡਿਲੀਵਰ ਕੀਤਾ ਜਾਵੇ